ਸ਼ੀਸ਼ ਆਸਣ ਬਾਰੇ ਅਸੀਂ ਗੱਲ ਕਰਦੇ ਹਾਂ ਅਸੀਂ ਯੋਗਾਜ਼ ਬਾਰੇ ਗੱਲ ਕਰਦੇ ਹਾਂ ਯੋਗਾਜ਼ ਜਿਆਦਾ ਉਮਰ ਦੇ ਵਿੱਚ ਬਹੁਤ ਹੀ ਸਿਹਤਮੰਦ ਔਰ ਸਿਹਤ ਨੂੰ ਠੀਕ ਰੱਖਣ ਦਾ ਇੱਕ ਬਹੁਤ ਹੀ ਉਪਰਾਲਾ ਹੈ ਯੋਗਾ ਜਿਹਦੇ ਵਿੱਚ ਸੁਬਾਹ ਉੱਠ ਕੇ ਸਭ ਤੋਂ ਪਹਿਲਾਂ ਅਸੀਂ ਬਾਮਨ ਕਰ ਸਕਦੇ ਆਂ ਬਾਮਨ ਦਾ ਕੀ ਮਤਲਬ ਪਾਣੀ ਤਿੰਨ ਚਾਰ ਗਲਾਸ ਪੀਕੇ ਉਹਨੂੰ ਉਗਲੀਆਂ ਰਾਹੀਂ ਮੂੰਹ ਰਾਹੀਂ ਕੱਢਣਾ ਤਾਂ ਕਿ ਸਾਡੀ ਜਿੰਨੀ ਵੀ ਸਰੀਰ ਦੇ ਵਿੱਚ ਟੋਕਸੀਨ ਉਹ ਸਾਰੇ ਨਿਕਲ ਕੇ ਬਾਹਰ ਆਉਂਦੇ ਆ ਉਹਦੇ ਨਾਲ ਕੀ ਸਰੀਰ ਫੁਰਤੀਲਾ ਰਹਿੰਦਾ ਆ ਸਰੀਰ ਲਚੀਲਾ ਰਹਿੰਦਾ ਹੈ ਔਰ ਅਸੀਂ ਸਾਰੇ ਦਿਨ ਨੱਠ ਭੱਜਨ ਦੀ ਹਨਾ ਵਿੱਚ ਵਿਅਸਤ ਰਹਿ ਸਕਦੇ ਹਾਂ ਔਰ ਅਸੀਂ ਸ਼ੀਸ਼ ਆਸਣ ਕਰ ਸਕਦੇ ਹਾਂ ਸ਼ੀਸ਼ ਆਸਣ ਦੀ ਸਭ ਤੋਂ ਵੱਡੀ ਵਧੀਆ ਚੀਜ਼ ਇਹ ਹੈ ਕਿ ਸ਼ੀਸ਼ ਆਸਣ ਦੇ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਵੱਧਦੀ ਆ ਖੂਨ ਦਾ ਸੰਚਾਰ ਹੁੰਦਾ ਹੈ ਔਰ ਬਾਲ ਝੜਨੇ ਬੰਦ ਹੁੰਦੇ ਆ ਔਰ ਚਿੱਟੀ ਸਫੇਦ ਬਾਲ ਜਿਹਦੇ ਆਏ ਹੋਣ ਉਹ ਵੀ ਕਾਲੇ ਵਾਲਾ ਚ ਕੰਨਵਰਟ ਹੋ ਜਾਂਦੇ ਆ ਜਦ ਕੀ ਸ਼ੀਸ਼ ਆਸਣ ਦਾ ਬਹੁਤ ਹੀ ਫਾਇਦਾ ਹੈ ਸੂਰਿਆ ਨਮਸਕਾਰ ਕਰ ਸਕਦੇ ਹਾਂ ਸ਼ੂਰਿਆ ਨਮਸਕਾਰ ਕਰਨ ਦੇ ਨਾਲ ਸਾਡੀ ਜਿਹੜੀ ਸਪਾਈਨ ਦੀ ਪ੍ਰੋਬਲਮ ਦੂਰ ਹੁੰਦੀ ਆ ਰੀਡ ਦੀ ਠੀਕ ਹੋ ਜਾਂਦੀ ਆ ਹੈਂ ਔਰ ਉਸ ਤੋਂ ਬਾਅਦ ਅਸੀਂ ਲੋਂਗ ਬਿਲੋਂਗ ਕਰ ਸਕਦੇ ਹਂ ਲੋਂਗ ਬਿਲੋਂਨ ਕਿਰਿਆ ਕਰਨਾ ਸਾਡੇ ਹਾਰਟ ਨੂੰ ਤਾਕਤ ਮਿਲਦੀ ਹ ਤਾਕਤ ਮਿਲਦੀ ਹ ਤਾਂ ਸਾਡਾ ਹਾਰਟ ਦੀ ਕੋਈ ਪ੍ਰੋਬਲਮ ਸਾਨੂੰ ਨਹੀਂ ਆ ਜਿੰਦਗੀ ਦੇ ਵਿੱਚ ਆਉਗੀ ਉਹ ਕਰ ਸਕਦੇ ਆ ਬਹੁਤ ਜਰੂਰੀ ਆ ਔਰ ਅਸੀਂ ਕੰਧ ਆਸਣ ਕਰ ਸਕਦੇ ਹਾਂ ਦੋਨੇ ਬਾਬਜ ਬਾਜਾ ਨੂੰ ਬਾਜੂਆਂ ਨੂੰ ਅੱਗੇ ਪਿੱਛੇ ਕਰਨਾ ਉਹਦੇ ਨਾਲ ਕੀ ਹੋਊ ਕੋਈ ਵੀ ਸਾਡੀ ਸਰਵਾਈਕਲ ਕੰਧ ਦੀ ਪ੍ਰੋਬਲਮ ਹੋਰ ਕੋਈ ਇਸਦਾ ਦੀ ਟੈਂਸ਼ਨ ਦੀ ਪ੍ਰੋਬਲਮ ਸਭ ਦੂਰ ਚਲ ਜਾਂਦੀ ਹ ਉਹਦੇ ਨਾਲ ਨਾਲ ਅਸੀਂ ਗੁਟਨੀਆ ਵਾਸਤੇ ਅਸੀਂ ਐਕਸਰਸਾਈਜ ਸਰ ਸਿਰ ਨੀਚੇ ਔਰ ਲੱਤਾਂ ਉਪਰ ਕਰਕੇ ਉਪਰ ਲਿਟ ਕੇ ਕੰਧ ਨਾਲ ਆਸਰਾ ਲੈ ਕੇ ਅਸੀਂ ਬਾਜੀ ਲੱਤਾਂ ਨੂੰ ਨੀਚੇ ਉੱਪਰ ਕਰ ਸਕਦੇ ਹਾਂ ਉਹਦੇ ਨਾਲ ਕੀ ਹੋਊਗਾ ਸਾਡੀ ਗੋਡਿਆਂ ਦੀ ਜਿਹੜੀ ਪ੍ਰੋਬਲਮ ਆ ਉਹ ਦੂਰ ਹੁੰਦੀ ਹ ਔਰ ਉਹਦੇ ਨਾਲ ਲਚੀਲਾਪਨ ਸਾਡੀ ਗੁਟਲੀਆ ਜਾਂਦਾ ਤਾਂ ਕਿ ਸਾਡੀ ਇਨੀ ਮਰਤਬਾ ਸਾਨੂੰ ਗੋਡੇ ਰੀਪਲੇਸ ਕਰਨ ਦੀ ਲੋੜ ਨਹੀਂ ਪੈ ਸਕਦੀ ਜਦਕਿ ਅੱਜਕੱਲ ਦੀ ਜਿਹੜੀ ਗੋਡਿਆਂ ਦੀ ਪ੍ਰੋਬਲਮ ਬਹੁਤ ਹੀ ਜਿਆਦਾ ਵਧ ਰਹੀ ਆ ਔਰ ਸਭ ਤੋਂ ਵੱਡੀ ਗੱਲ ਹ ਅਸੀਂ ਨੇਤਰੀ ਕਰ ਸਕਦੇ ਹਾਂ ਨੇਤਰੀ ਕੀ ਹੁੰਦਾ ਜਦੋਂ ਅਸੀਂ ਇੱਕ ਇੱਕ ਨੱਕ ਨੱਕ ਰਾਹੀਂ ਪਾਣੀ ਭਰ ਕੇ ਦੂਜੇ ਰਾਹੀਂ ਕੱਢਦੇ ਆ ਉਹਦੇ ਨਾਲ ਸਾਡੇ ਅੰਦਰ ਉਹਦੇ ਨਾਲ ਸਾਡਾ ਸਾਰਾ ਬਿਲਕੁਲ ਨਾਸਾ ਨਜ਼ਲ ਕਿ ਸਾਡੀ ਕਲੀਅਰ ਹੁੰਦੀ ਆ ਉਹਦੇ ਨਾਲ ਕੀ ਸਾਨੂੰ ਜੁਕਾਮ ਨਹੀਂ ਹੁੰਦਾ ਰੇਸ਼ਾ ਨੀ ਹੁੰਦੀ ਹੋਰ ਕੁਝ ਨਹੀਂ ਹੁੰਦਾ ਉਹ ਸਭ ਤੋਂ ਵਧੀਆ ਪ੍ਰੋਬਲਮ ਆ ਔਰ ਇਹਦੇ ਚ ਅਸੀਂ ਦੁੱਧ ਨੇਤਰੀ ਅਸੀ ਦੁੱਧ ਆਸਣ ਨਹੀਂ ਕਰ ਸਕਦੇ ਹਾਂ ਦੁੱਧ ਨੇਤਰੀ ਵੀ ਕਰ ਸਕਦੇ ਆਂ ਉਹਦੇ ਨਾਲ ਪੀਣ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਵਧੂਗੀ ਔਰ ਸਾਡੀ ਜੋ ਸੀਆ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ ਜਦਕਿ ਬਹੁਤ ਹੀ ਵਧੀਆ ਚੀਜ਼ ਆ ਅਸੀਂ ਇਹ ਸੁਣਿਆ ਵੀ ਸੀ ਅਸੀਂ ਯੋਗਾ ਵਾਲੇ ਕਰ ਦੇ ਦੱਸਦੇ ਵੀ ਆ ਕਿ ਯੋਗਾ ਕਰਨ ਦੇ ਬਹੁਤ ਹੀ ਜਿਆਦਾ ਅਣਗਿਣਤ ਫਾਇਦੇ ਆ ਔਰ ਸਾਡੇ ਸਾਰੇ ਲੋਕਾਂ ਨੂੰ ਇਸ ਉਮਰ ਦੇ ਵਿੱਚ ਸਾਡੇ ਉਮਰ ਦੇ ਲੋਕਾਂ ਨੂੰ ਸਵੇਰ ਉੱਠ ਕੇ ਯੋਗਾਜ਼ ਯੋਗਾਜ਼ ਕਰਨਾ ਚਾਹੀਦਾ ਯੋਗਾ ਕਰਨਾ ਨੱਠਣਾ ਚਾਹੀਦਾ ਯੋਗਿਜ਼ ਕਰਨੀ ਚਾਹੀਦੀ ਆ ਔਰ ਨੱਠਣ ਦੇ ਨਾਲ ਸਾਡੀ ਸਿਹਤ ਸਿਹਤ ਠੀਕ ਰਹੂਗੀ ਔਰ ਸਾਡੀ ਜਿਹੜੀ ਫੁਰਤੀ ਰਹੂਗੀ ਯੋਗਾ ਵਿੱਚ ਕਿਹਾ ਗਿਆ ਜੇ ਅਸੀਂ ਸਾਰਾ ਦਿਨ ਇੱਕ ਘੰਟਾ ਅਸੀਂ ਯੋਗਾਂ ਨੂੰ ਦਈਏ ਤਾਂ ਉਹ ਤੇਈ ਘੰਟੇ ਸਾਨੂੰ ਨਾ ਫੁਰਤੀ ਦਿੰਦਾ ਆ ਤੇਈ ਘੰਟੇ ਸਾਡੀ ਫੁਰਤੀ ਨੂੰ ਸਰੀਰ ਨੂੰ ਇਦਾਂ ਲੈ ਕੇ ਜਾਊਗਾ ਤਾਂ ਕਿ ਜਾ ਕੀ ਅਸੀਂ ਸਾਰਾ ਦਿਨ ਕੋਈ ਥਕਾਵਟ ਨਾ ਦੀ ਚੀਜ਼ ਮਹਿਸੂਸ ਨਹੀਂ ਕਰ ਸਕਦੇ ਤੇ ਇਸ ਲਈ ਯੋਗਾ ਦੀਆ ਅਣਗਿਣਤ ਫਾਇਦੇ ਨੇ ਔਰ ਸਾਡੀ ਉਮਰ ਵਿੱਚ ਹਰ ਇੱਕ ਨੂੰ ਯੋਗਾ ਕਰਨਾ ਬਹੁਤ ਹੀ ਜਰੂਰੀ ਹੈ ਜਿਹਦੇ ਕਿ ਅਣਗਿਣਤ ਫਾਇਦੇ ਨੇ